ਯਾਤਰਾ ਦੇ ਵਿੱਚ ਜੀ ਆਪਾਂ ਨੂੰ ਮੰਨ ਲਓ ਜੀ ਪ੍ਰੋਪਰ ਪਾਣੀ ਹੋਣਾ ਚਾਹੀਦਾ ਜੀ ਕੋਲ ਆਪਾਂ ਜਿਵੇਂ ਦੂਰ ਦੀ ਯਾਤਰਾ ਜਾ ਰਹੇ ਹਾਂ ਜਾਣਾ ਜਾਣਾ ਚਾਹੁੰਦੇ ਹਾਂ ਜੀ ਮੰਨ ਲਓ ਅਮਰਨਾਥ ਜਾਣਾ ਹੈ ਜੀ ਠੀਕ ਹੈ ਯਾਤਰਾ ਦੇ ਉੱਤੇ ਜਾਂਦੇ ਹਾਂ ਅਤੇ ਪ੍ਰੋਪਰ ਖਾਣਾ ਆਪਾਂ ਨੂੰ ਜ਼ਿਆਦਾ ਖਾਣਾ ਨਹੀਂ ਚਾਹੀਦਾ ਭੁੱਖ ਨਾਲੋਂ ਘੱਟ ਖਾਣਾ ਖਾਣਾ ਖਾਣਾ ਚਾਹੀਦਾ ਜੀ ਠੀਕ ਆ ਉਸ ਤੋਂ ਬਾਅਦ ਜੀ ਆਪਾਂ ਨੂੰ ਕੋਈ ਚੰਗੀ ਚੀਜ਼ ਹਲਕੀ ਚੀਜ਼ ਖਾਣੀ ਚਾਹੀਦੀ ਜ਼ਿਆਦਾ ਭੋਜਨ ਮੰਨ ਲਓ ਜੀ ਹਾਰਡ ਭੋਜਨ ਨਹੀਂ ਖਾਣਾ ਚਾਹੀਦਾ ਆਪਾਂ ਨੂੰ ਹਲਕਾ ਭੋਜਨ ਖਾਣਾ ਚਾਹੀਦਾ ਜਿਵੇਂ ਮੰਨ ਲਓ ਜੀ ਆਪਾਂ ਚੌਲ ਹੋ ਗਏ ਆ ਇਹ ਚੀਜ਼ ਹੋ ਗਈ ਆ ਠੀਕ ਆ ਜਾਂ ਸੇਬ ਹੋ ਗਏ ਫਲ ਹੋ ਗਿਆ ਮਤਲਬ ਵਧੀਆ ਇਹ ਚੀਜ਼ ਖਾਣੀ ਚਾਹੀਦੀ ਆ ਠੀਕ ਉਹ ਯਾਤਰਾ ਦੇ ਵਿੱਚ ਆਪਾਂ ਨੂੰ ਪਰੇਸ਼ਾਨੀ ਨਹੀਂ ਆਉਂਦੀ ਜੀ ਬਹੁਤ ਵਧੀਆ ਰਹਿੰਦੀ ਆ ਪਾਣੀ ਜ਼ਰੂਰ ਕੋਲ ਰੱਖਣਾ ਚਾਹੀਦਾ ਆਪਾਂ ਨੂੰ ਜੀ ਪਾਣੀ ਤੋਂ ਬਿਨਾਂ ਆਪਾਂ ਮੰਨ ਲਓ ਯਾਤਰਾ ਵੀ ਨਹੀਂ ਕਰ ਸਕਦੇ ਉਹ ਸਭ ਤੋਂ ਵਧੀਆ ਚੀਜ਼ ਹੈ ਜੀ ਠੀਕ ਹੈ ਪ੍ਰੋਪਰ ਮੰਨ ਲਓ ਜੀ ਠੀਕ ਹੈ ਜੀ ਹੋਰ ਆਪਣੇ ਜਿਹੜੇ ਵੀ ਹੁਣ ਅੱਗੇ ਜਿਹੜੀ ਯਾਤਰਾ ਦੀ ਜਗ੍ਹਾ ਦੇ ਕੋਲ ਜਾਵਾਂਗੇ ਉੱਥੇ ਵੀ ਆਪਾਂ ਖਾਣਾ ਖਾਵਾਂਗੇ ਤਾਂ ਸਭ ਤੋਂ ਥੋੜ੍ਹੇ ਤੋਂ ਥੋੜ੍ਹਾ ਖਾਵਾਂਗੇ ਜ਼ਿਆਦਾ ਨਹੀਂ ਖਾਵਾਂਗੇ ਵੀ ਆਪਾਂ ਨੂੰ ਤਕਲੀਫ ਨਾ ਆਵੇ ਜਿਹੜੀ ਜੇ ਜ਼ਿਆਦਾ ਖਾਣਾ ਖਾਵਾਂਗੇ ਤਾਂ ਆਪਾਂ ਬਿਮਾਰ ਵੀ ਹੋ ਸਕਦੇ ਹਾਂ ਠੀਕ ਹੈ ਜ਼ਿਆਦਾ ਬਿਮਾਰ ਹੋ ਕੇ ਤੁਹਾਨੂੰ ਪ੍ਰੋਬਲਮ ਹੋ ਸਕਦੀ ਆਪਣੀ ਯਾਤਰਾ ਜਿਹੜੀ ਕੋਈ ਕਰਨ ਖਾਤਰ ਜਾ ਰਹੇ ਆ ਉਹ ਆਪਣੀ ਅੱਧ ਵਿਚਾਲੇ ਹੀ ਰਹਿ ਸਕਦੀ ਹੈ ਪ੍ਰੋਪਰ ਇਸ ਲਈ ਇਹ ਆਪਾਂ ਨੂੰ ਉਹ ਜਿਹੀਆਂ ਨਰਮ ਚੀਜ਼ਾਂ ਆਪਾਂ ਘਰ ਦੇ ਵਿੱਚ ਕੋਈ ਚੀਜ਼ ਬਣਾ ਕੇ ਲੈ ਜਾਣੀ ਹੈ ਤਾਂ ਉਹ ਜ਼ਿਆਦਾ ਮਿੱਠੀ ਵਾਲੀ ਵੀ ਨਹੀਂ ਅਤੇ ਜ਼ਿਆਦਾ ਕਰਾਰੇ ਵਾਲੀ ਵੀ ਨਹੀਂ ਆਲਾ ਮੀਡੀਅਮ ਮਸਾਲਾ ਮੀਡੀਅਮ ਚੀਜ਼ ਪਾ ਬਣਾ ਕੇ ਲੈ ਕੇ ਜਾਣੀ ਚਾਹੀਦੀ ਹੈ ਉੱਥੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ ਆਪਾਂ ਯਾਤਰਾ ਸਫਲ ਵਧੀਆ ਕਰ ਲਈਏ ਜਾਈਏ ਵੀ ਅਤੇ ਵਾਪਸ ਵਧੀਆ ਆਪਦੀ ਤੰਦਰੁਸਤੀ ਆਪਦੇ ਘਰ ਆਪਾਂ ਵਾਪਸ ਆਈਏ ਸਭ ਤੋਂ ਵਧੀਆ ਚੀਜ਼ ਇਹੀ ਹੈ ਜੀ